ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਪਪਰਾਲਾ ਪਿੰਡ ਹੈ ਉਸ ਤੋਂ ਉੱਥੋਂ ਬੋਲਦੀ ਹਾਂ ਅਤੇ ਸਰ ਤੁਹਾਡਾ ਸਾਊਥ ਇੰਡੀਅਨ ਰੈਸਟੋਰੈਂਟ ਹੈ ਇਹਦੇ ਬਾਰੇ ਕਾਫੀ ਪੁੱਛ ਸੁਣਿਆ ਗਿਆ ਹੈ ਕਿ ਬਹੁਤ ਫੇਮਸ ਹੈ ਸਰ ਮੈਂ ਤੁਹਾਤੋਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਅੱਜ ਦਾ ਜਿਹੜਾ ਸਪੈਸ਼ਲ ਹੈ ਤੁਹਾਡੇ ਰੈਸਟੋਰੈਂਟ ਵਿੱਚ ਤੁਸੀਂ ਕੀ ਬਣਾ ਰਹੇ ਹੋ ਓਕੇ ਸਰ ਠੀਕ ਹੈ ਜੀ ਅੱਛਾ ਸਰ ਤੁਹਾਡਾ ਜਿਹੜਾ ਡੋਸਾ ਹੈ ਡੋਸਾ ਠੀਕ ਹੈ ਸਰ ਇਹ ਮੈਨੂੰ ਥੋੜ੍ਹਾ ਇਹਦੇ ਬਾਰੇ ਇਹ ਆਈਡੀਆ ਦਿਉ ਕਿ ਜਿਹੜਾ ਡੋਸਾ ਹੈ ਇਹ ਮਤਲਬ ਕਿਵੇਂ ਤੁਸੀਂ ਜਿੱਦਾਂ ਕਿ ਇਹ ਦੀਆਂ ਵੀ ਕਾਫੀ ਟਾਈਪਸ ਹੁੰਦੀਆਂ ਹੈ ਕਿ ਕਿਸ ਪ੍ਰਕਾਰ ਦਾ ਤੁਸੀਂ ਜਿਹੜਾ ਇਹ ਡੋਸਾ ਹੈ ਇਹ ਤੁਸੀਂ ਬਣੇ ਰਹੇ ਹੋ ਜਿਹੜਾ ਅੱਜ ਦਾ ਤੁਹਾਡਾ ਸਪੈਸ਼ਲ ਹੈ ਅਤੇ ਮੈਨੂੰ ਸਰ ਇੱਕ ਫਿਰ ਜਿਹੜਾ ਹੈਗਾ ਪੈਕਿੰਗ ਇਹ ਨਾ ਤੁਸੀਂ ਹੋਮ ਡਿਲੀਵਰੀ ਕਰ ਦਿਉ ਤੁਹਾਨੂੰ ਮੈਂ ਐਡਰੱਸ ਆਪਣਾ ਲਿਖਵਾ ਦਿੰਦੀ ਹਾਂ ਪਿੰਡ ਪਪਰਾਲਾ ਨੇੜੇ ਪੁਲਿਸ ਲਾਈਨ ਹਾਂਜੀ ਸਰ ਅਤੇ ਇਹ ਤੁਸੀਂ ਪਲੀਸ ਜਿਹੜੀ ਵੀ ਤੁਹਾਡੀ ਅੱਜ ਦੀ ਹਾਂਜੀ ਸਪੈਸ਼ਲ ਡਿਸ਼ ਹੈ ਮੈਨੂੰ ਪਤਾ ਲੱਗ ਗਿਆ ਤਾਂ ਕਿਰਪਾ ਕਰਕੇ ਇਹ ਤੁਸੀਂ ਅੱਜ ਪਹੁੰਚਾਉ ਤਾਂ ਕਿ ਅਸੀਂ ਵੀ ਜਿੰਨਾ ਤੁਹਾਡਾ ਨਾਮ ਸੁਣਿਆ ਹੈ ਤੁਹਾਡੇ ਰੈਸਟੋਰੈਂਸ ਦਾ ਅਸੀਂ ਵੀ ਉਹਨੂੰ ਟੇਸਟ ਕਰਕੇ ਤੁਹਾਡੇ ਜਿਹੜੇ ਵੈੱਲ ਵਿਸ਼ਰ ਹੈ ਉਨ੍ਹਾਂ ਦੀ ਲਿਸਟ ਵਿੱਚ ਆਈਏ ਥੈਂਕ ਊ ਸਰ